ਮੈਂ ਸਕਰੈਚ ਤੋਂ ਬਹੁਤ ਸਾਰੇ ਪਕਵਾਨ ਬਣਾਉਂਦੀ ਰਹਿੰਦੀ ਹਾਂ ਅਗਰ ਮੈਂ ਗੱਲ ਕਰਾਂ ਕੁਝ ਦਿਨ ਪਹਿਲਾਂ ਦੀ ਤਾਂ ਮੈਂ ਲਾਸਟ ਟਾਈਮ ਹੁਣ ਇੱਕ ਪ੍ਰੋਪਰ ਪੂਰਾ ਚਾਈਨੀਸ ਮਨਚੂਰੀਅਨ ਬਣਾਇਆ ਸੀਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਬਜ਼ੀਆਂ ਜੋ ਬਾਜ਼ਾਰ ਤੋਂ ਲੈ ਕੇ ਆਈ ਜਿ ਜਿਨਾਂ ਵਿੱਚ ਜਿਵੇਂ ਕਿ ਪੱਤਾ ਗੋਭੀ ਹੋਗੀ ਗੋਭੀ ਗਾਜਰ ਇਹ ਸਾਰੀ ਸਬਜ਼ੀਆਂ ਲੈ ਕੇ ਆਈ ਫਿਰ ਮੈਂ ਘਰ ਲੈ ਕੇ ਆਈ ਅਤੇ ਉਹਨਾਂ ਨੂੰ ਧੋਇਆ ਅਤੇ ਅੱਛੀ ਤਰ੍ਹਾਂ ਕੱਦੂਕਸ ਕੀਤਾ ਬਿਲਕੁਲ ਬਰੀਕ ਬਰੀਕ ਕਰਿਆ ਅਤੇ ਫਿਰ ਉਸਨੂੰ ਮਨਚੂਰੀਅਨ ਵਾਲੇ ਜੋ ਅਸੀਂ ਪੇਸਟ 'ਚ ਉਹਦੇ ਵਿੱਚ ਬਿਲਕੁਲ ਮਿਕਸ ਕਰਕੇ ਅਤੇ ਉਂਦੀ ਬੋਲਜ਼ ਬਣਾਈਆਂ ਫਿਰ ਮੈਂ ਸਾਰੇ ਸੋਸ ਵਗੈਰਾ ਵਿੱਚ ਉਹਨਾਂ ਨੂੰ ਤੜਕਿਆ ਅਤੇ ਅੱਛੀ ਤਰ੍ਹਾਂ ਨਾਲ ਬਿਲਕੁਲ ਪ੍ਰੋਪਰ ਚਾਈਨੀਜ਼ ਮਨਚੂਰੀਅਨ ਬਣਾਇਆ ਫਿਰ ਮੈਂ ਆਪਣੇ ਫੈਮਲੀ 'ਚ ਸਾਰਿਆਂ ਨੂੰ ਸਰਵ ਕੀਤਾ ਸਭ ਨੂੰ ਦਿੱਤਾ ਫਿਰ ਉਹਨਾਂ ਸਭ ਨੂੰ ਵੀ ਬਹੁਤ ਪਸੰਦ ਆਇਆ ਇਸ ਦੀ ਪਰ ਪ੍ਰੇਰਨਾ ਮੈਨੂੰ ਸੰਜੀਵ ਕਪੂ ਕਪੂਰ ਸ਼ੈਫ ਕੋਲੋਂ ਮਿਲੀ ਜਿਸਦੀ ਕਿ ਵੀਡੀਓਜ਼ ਮੈਂ ਅਕਸਰ ਯੂਟਿਊਬ ਤੋਂ ਵੇਖਦੀ ਰਹਿੰਦੀ ਹਾਂ ਜੋ ਕਿ ਬਹੁਤ ਵਧੀਆ ਵਧੀਆ ਪਕਵਾਨ ਬਣਾਉਂਦੇ ਆ ਮੈ ਉਹਨਾਂ ਨੂੰ ਅਕਸਰ ਉਹਨਾਂ ਦੀ ਦਿੱਤੀਆਂ ਜੋ ਵੀ ਉਹ ਬਣਾਉਂਦੇ ਆ ਮੈਂ ਉਹਨਾਂ ਨੂੰ ਵੀ ਖੁਦ ਵੀ ਟਰਾਈ ਕਰਦੀ ਰਹਿੰਦੀ ਹਾਂ ਘਰੇ ਕੁਝ ਨਾ ਕੁਝ ਬਣਾਉਂਦੀ ਹਾਂ